ਭੰਗੜਾ ਪੰਜਾਬੀਆਂ ਦੀ ਆਨ ਬਾਨ ਸ਼ਾਨ ਹੈ ਭੰਗੜ ਭੰਗੜਾ ਪੰਜਾਬੀਆਂ ਦਾ ਮਨਪਸੰਦ ਲੋਕ ਨਾਚ ਹੈ ਭੰਗੜੇ ਦੀ ਪਛਾਣ ਪੰਜਾਬੀਆਂ ਦੀ ਪਛਾਣ ਭੰਗੜੇ ਤੋਂ ਹੀ ਹੁੰਦੀ ਹੈ ਭੰਗੜੇ

ਢੋਲ ਦੀ ਡਗੇ ਤੋਂ ਹੀ ਭੰਗੜੇ ਦੀ ਸਟਾਟਿੰਗ ਹੁੰਦੀ ਹੈ ਭੰਗੜੇ ਲੇ ਮੁੱਖ ਗੀਤ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਰਹੇ ਦੇਦੇ ਗੇੜਾ ਸ਼ੌਂਕ ਦਾ ਨਣਾਨੇ ਗੋਰੀਏ ਲੱਕ ਟਵੈਂਟੀ ਏਟ ਕੁੜੀ ਦਾ ਫੋਟੀ ਸੈਵਨ ਵੇਟ ਕੁੜੀ ਦਾ ਪਹਿਰਾ ਲੱਗਦਾ ਰਾਤੀਂ ਮਿਲਣ ਨਾ ਆਈਂ ਵੇ ਚੱਕਲੋ ਰੱਬ ਦਾ ਨਾਂ ਲੈ ਕੇ ਰੰਨ ਬੋਤਲ ਵਰਗੀ ਇਹ ਪੰਜਾਬੀਆਂ ਦੇ ਮੁੱਖ ਭੰਗੜਾ ਸੋਂਗ ਗਾਣੇ ਹਨ ਇਹ ਅਤੇ ਇਸ ਗਾਣਿਆਂ 'ਤੇ ਲੋਕ ਹੁੰਮ ਹੁਮਾ ਕੇ ਵਿਆਹਾਂ ਵਿੱਚ ਨੱਚਦੇ ਹਨ